ਅੱਜ ਕੱਲ੍ਹ ਪੰਜਾਬ ਵਿੱਚ ਸਾ ਨੋ ਡਿਸਕ੍ਰੀਮੀਨੇਸ਼ਨ ਚੀਜ਼ਾਂ ਚੱਲ ਰਹੀਆਂ ਹਨ ਜਿੱਥੇ ਕਿ ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਵੀ ਫਰਕ ਨਹੀਂ ਕੀਤਾ ਜਾਂਦਾ ਜਿਹੜੀਆਂ ਗੇਮ ਮੁੰਡੇ ਅਤੇ ਕੁੜੀਆਂ ਖੇਡ ਰਹੇ ਹਨ ਅਤੇ ਉਹੀ ਕੁੜੀਆਂ ਖੇਡ ਸਕਦੀਆਂ ਹਨ ਜਿਵੇਂ ਕਿ ਕ੍ਰਿਕਟ ਹੋ ਗਿਆ ਖੋ ਖੋ ਹੋ ਗਈ ਕਬੱਡੀ ਹੋ ਗਿਆ ਸਾਰੀਆਂ ਚੀਜ਼ਾਂ ਐਜ਼ ਆ ਕੰਪੇਅਰ ਵਿੱਦ ਬੋਆਇਜ਼ ਕੁੜੀਆਂ ਵੀ ਖੇਡ ਰਹੀਆਂ ਹਨ ਲਾਈਫ 'ਚ ਅਤੇ ਬਹੁਤ ਹੀ ਜ਼ਿਆਦਾ ਖੁਸ਼ ਹਨ ਕਿਉਂਕਿ ਅੱਜ ਕੱਲ੍ਹ ਸਮਾਜ ਵਿੱਚੋਂ ਜਿਹੜਾ ਡਿਸਕ੍ਰੀਮੀਨੇਸ਼ਨ ਐਜ਼ ਆ ਲੈ ਕੇ ਗਰਲਸ ਨੂੰ ਲੈ ਕੇ ਉਹ ਸਾਰਾ ਹੀ ਖਤਮ ਹੋ ਗਿਆ ਹੈ ਅਤੇ ਕੁੜੀਆਂ ਵੀ ਅੱਜ ਕੱਲ੍ਹ ਐਜ਼ ਆ ਬੋਆਇਜ਼ ਦੀ ਤਰ੍ਹਾਂ ਹਰ ਇੱਕ ਜਗ੍ਹਾ ਜਾ ਕੇ ਰਾਤ ਬਾਹਰ ਰਹਿ ਕੇ ਆਪਣਾ ਚੀਜ਼ਾਂ ਨੂੰ ਪਾਰਟੀਸੀਪੇਟ ਕਰਕੇ ਆਪਣੇ ਆਪ ਨੂੰ ਅੱਗੇ ਆ ਕੇ ਸ਼ੋ ਕਰ ਰਹੀਆਂ ਹਨ ਰੀਪਰਜੈਂਟ ਕਰ ਰਹੀਆਂ ਹਨ ਸਾਰਿਆਂ ਅੱਗੇ ਤਾਂ ਕਿ ਉਹ ਵੀ ਇੱਕ ਪੱਧਰ 'ਤੇ ਆ ਕੇ ਜਿੱਤ ਸਕਣ ਅਤੇ ਸਾਨੂੰ ਵੀ ਮਾਣ ਹੋ ਰਿਹਾ ਕਿ ਸਾਡੇ ਪੰਜਾਬ ਨੇ ਜਿਹੜਾ ਡਿਸਕ੍ਰੀਮੀਨੇਸ਼ਨ ਹੈ ਗਰਲਜ਼ ਦੇ ਵਿੱਚ ਉਹਨੂੰ ਖਤਮ ਕਰ ਦਿੱਤਾ ਹੈ ਅਤੇ ਉਹਨੂੰ ਅੱਗੇ ਲੈ ਕੇ ਜਾਣ ਦਾ ਕੁੜੀਆਂ ਨੂੰ ਅੱਗੇ ਇੱਕ ਆਪਣਾ ਫਿਊਚਰ ਬਣਾਉਣ ਦਾ ਸਿਕਿਓਰ ਕਰਨ ਦਾ ਟਾਈਮ ਦਿੱਤਾ ਅਤੇ ਅੱਜ ਕੱਲ੍ਹ ਕੁੜੀਆਂ ਬੇਖੌਫ ਹੋ ਕੇ ਕਿਤੇ ਵੀ ਜਾ ਸਕਦੀਆਂ ਹਨ ਖੇਲ ਸਕਦੀਆਂ ਹਨ ਸਭ ਕੁਛ ਕਰ ਸਕਦੀਆਂ ਹਨ ਇਹ ਚੀਜ਼ ਮੈਨੂੰ ਬਹੁਤ ਹੀ ਵਧੀਆ ਲੱਗੀ